ਹੈਲੋ ਹਾਂਜੀ ਹਾਂਜੀ ਹਾਂਜੀ ਹਾਂਜੀ ਬਹੁਤ ਟਰੈਫਿਕ ਹੁੰਦਾ ਤੁਹਾਨੂੰ ਪਤਾ ਇੰਨਾ ਰਸ਼ ਹੁੰਦਾ ਇੰਨੇ ਵਹੀਕਲਸ ਹੁੰਦੇ ਨੇ ਤੁਹਾਨੂੰ ਪਤਾ ਸਕੂਟੀ ਵਗੈਰਾ ਕਰਨੀ ਔਖੀ ਹੋ ਜਾਂਦੀ ਹੈ ਹਾਂਜੀ ਹਾਂਜੀ ਕਿਉਂਕਿ ਅੱਜ ਦੇ ਟਾਈਮ ਵਿੱਚ ਮੈਡਮ ਤੁਹਾਨੂੰ ਪਤਾ ਹਰੇਕ ਇਨਸਾਨ ਇੱਕ ਦੂਜੇ ਤੋਂ ਅੱਗੇ ਨਿਕਲਣਾ ਚਾਹੁੰਦਾ ਬਈ ਹਾਂ ਬਸ ਮੈਂ ਜਲਦੀ ਪਹੁੰਚ ਜਾਵਾ ਹਾਂਜੀ ਹਾਂਜੀ ਟਰੈਫਿਕ ਤਾਂ ਬਹੁਤ ਹੁੰਦਾ ਮਾਰਕੀਟ ਵਿੱਚ ਤਾਂ ਬਹੁਤ ਜਿਆਦਾ ਕਿਉਂਕਿ ਤੁਹਾਡਾ ਘਰ ਵੀ ਉਸ ਸਾਈਡ ਹੈ ਨਾ ਫਿਰ ਤੁਹਾਨੂੰ ਆਉਣਾ ਵੀ ਉਧਰੋਂ ਹੀ ਪੈਂਦਾ ਹੈਗਾ ਕਿਉਂਕਿ ਤੁਹਾਡੀ ਮਜ਼ਬੂਰੀ ਹੈ ਫਿਰ ਉਧਰੋਂ ਆਉਣਾ ਹੀ ਹੋਰ ਕੋਈ ਰੋਡ ਵੀ ਨਹੀਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਂ ਤਾਂ ਆਪ ਮੈਮ ਇਸ ਕਰਕੇ ਕਈ ਵਾਰੀ ਤੁਹਾਨੂੰ ਪਤਾ ਬਹੁਤ ਵਾਰ ਮੈਂ ਵੀ ਲੇਟ ਹੋ ਜਾਂਦੀ ਹਾਂ

ਹਾਂਜੀ ਬਿਲਕੁਲ ਹੋਣਾ ਚਾਹੀਦਾ ਬਿਲਕੁਲ ਮੈਡਮ ਕੰਟਰੋਲ ਤਾਂ ਹੋਣਾ ਚਾਹੀਦਾ ਟਰੈਫਿਕ 'ਤੇ ਕਿਉਂਕਿ ਇੰਪਰੂਵਮੈਂਟ ਨਾ ਹੋਏਗੀ ਤਾਂ ਤੁਹਾਨੂੰ ਪਤਾ ਦਿਨੋਂ ਦਿਨ ਇਹ ਵੱਧਦਾ ਜਾ ਰਿਹਾ ਹਾਂਜੀ

ਹਾਂਜੀ ਹੋਣਾ ਚਾਹੀਦਾ ਮੈਡਮ ਇਹ ਸੁਧਾਰ ਬਿਲਕੁਲ ਹੋਣੇ ਚਾਹੀਦੇ ਨੇ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਚਲੋ ਠੀਕ ਹੈ ਮੈਮ